ਹਾਂਜੀ ਜ਼ਿਆਦਾ ਤਾਂ ਨਹੀਂ ਬਟ ਹਾਂ ਥੋੜ੍ਹਾ ਬਹੁਤ ਦੱਸ ਸਕਦੇ ਹਾਂ ਕਿ ਜਦੋਂ ਤੁਸੀਂ ਕੋਈ ਵੀ ਜਮੀਨ ਖਰੀਦਣ ਰਿਹਾ ਜਾਂ ਵੇਚ ਰਿਹਾ ਤਾਂ ਸਭ ਤੋਂ ਪਹਿਲਾਂ ਮੈਂ ਜਮੀਨ ਖਰੀਦਣ ਵਾਲਿਆਂ ਦੀ ਗੱਲ ਕਰਾਂਗੀ ਜਮੀਨ ਖਰੀਦਣੀ ਹੋਵੇ ਤਾਂ ਸਾਰੀਆਂ ਲੀਗਲ ਫੋਰਮੈਲਿਟੀਜ਼ ਜਿਹੜੀਆਂ ਨੇ ਉਹ ਜ਼ਰੂਰੀ ਨੇ ਕਰਨੀਆਂ ਔਰ ਇੱਕ ਵਾਰੀ ਸਿਰਫ ਕੈ ਲੋਕਾਂ ਦੇ ਕਹਿਣ 'ਤੇ ਹੀ ਯਕੀਨ ਨਹੀਂ ਕਰ ਲੈਣਾ ਚਾਹੀਦਾ ਵੀ ਇੱਥੇ ਜ ਜਮੀਨ ਹੈਗੀ ਆ ਦੋ ਚਾਰ ਲੋਕਾਂ ਤੋਂ ਪੁੱਛਗਿਛ ਵੀ ਕਰਨੀ ਚਾਹੀਦੀ ਹੈ ਕਿ ਜਮੀਨ ਦਾ ਕੋਈ ਕੇਸ ਤਾਂ ਨਹੀਂ ਚੱਲਦਾ ਜਾਂ ਕੋਈ ਰੌਲਾ ਤਾਂ ਨਹੀਂ ਹੈਗਾ ਜਾਂ ਕੋਈ ਝਗੜਾ ਤਾਂ ਨਹੀਂ ਹੈਗਾ ਜੇ ਉਹ ਜਮੀਨ ਦਾ ਕੋਈ ਝਗੜਾ ਨਹੀਂ ਹੈ ਕੋਈ ਰੌਲਾ ਨਹੀਂ ਹੈ ਉਹਦੇ ਕਾਗਜ਼ ਪੂਰੇ ਨੇ ਤਾਂ ਫਿਰ ਉਹ ਜਮੀਨ ਜਿਹੜੀ ਆ ਉਹ ਲੈਣ ਬਾਰੇ ਸੋਚਣਾ ਚਾਹੀਦਾ ਅਤੇ ਵੇਚਣ ਵਾਲਿਆਂ ਨੂੰ ਸਿਰਫ ਇਹ ਹੀ ਕਹਾਂਗੇ ਕਿ ਜਦੋਂ ਤੁਸੀਂ ਜਮੀਨ ਵੇਚਦੇ ਹੋ ਤਾਂ ਉਹ ਜਮੀਨ ਜਿਹੜੀ ਆ ਉਹਦੇ ਸਾਰੇ ਕਾਗਜ਼ ਪੂਰੇ ਹੋਣੇ ਚਾਹੀਦੇ ਆ ਉਹਦੀਆਂ ਲੀਗਲ ਫੋਰਮੈਲਿਟੀਜ਼ ਜਿੰਨੀਆਂ ਹੈਗੀਆਂ ਨੇ ਉਹ ਸਾਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਅਤੇ ਸਿਰਫ ਆਪਣੇ ਪੈਸੇ ਕਮਾਉਣ ਪਿੱਛੇ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਉਹ ਹੀ ਜਮੀਨ ਜਿਹੜੀ ਹੈ ਇੱਕ ਕਿਸੇ ਨੂੰ ਮਤਲਬ ਦੋ ਤਿੰਨ ਜਾਣਿਆਂ ਨੂੰ ਵੇਚੀ ਹੋਵੇ ਝਗੜੇ ਵਾਲੀ ਜਮੀਨ ਨਹੀਂ ਵੇਚਣੀ ਚਾਹੀਦੀ ਸਿਰਫ ਆਪਣੇ ਪ੍ਰੋਫਿਟ ਵਾਸਤੇ ਜਾਂ ਆਪਣਾ ਪ੍ਰੋਫਿਟ ਹੋ ਰਿਹਾ ਤਾਂ ਜਮੀਨ ਜਿਹੜੀ ਆ ਕਿਸੇ ਨੂੰ ਵੀ ਵੇਚ ਦਿਓ ਅਤੇ ਉਸ ਤੋਂ ਬਾਅਦ ਕਿਹੜਾ ਪੁੱਛਗਿਛ ਕਰਨੀ ਹੈ ਆਪਣਾ ਗਲਤ ਨੰਬਰ ਨਹੀਂ ਦੇਣਾ ਚਾਹੀਦਾ ਆਪਣੀਆਂ ਕਰੈ ਡਿਟੇਲਸ ਜਿਹੜੀਆਂ ਨੇ ਉਹ ਕਰੈਕਟ ਦੱਸਣੀਆਂ ਚਾਹੀਦੀਆਂ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਲੋਕ ਕੀ ਕਰਦੇ ਨੇ ਤੇ ਆਪਣੀਆਂ ਗਲਤ ਡਿਟੇਲਸ ਦੱਸਦੇ ਨੇ ਔਰ ਜਮੀਨ ਵੇਚ ਦਿੰਦੇ ਨੇ ਔਰ ਉਹ ਬਾਅਦ 'ਚ ਪਤਾ ਚੱਲਦਾ ਕਿ ਉਹ ਜ਼ਮੀਨ ਜਿਹੜੀ ਸੀਗੀ ਰੌਲੇ ਵਾਲੀ ਸੀਗੀ ਉਹਦਾ ਤਾਂ ਕੇਸ ਚੱਲਦਾ ਸੀਗਾ ਉਹਦਾ ਕੋਈ ਕਾਗਜ਼ ਪੱਤਰ ਨਹੀਂ ਹੈਗਾ ਔਰ ਦੋ ਤਿੰਨ ਲੋਕਾਂ ਦੇ ਪਹਿਲੇ ਵੀ ਲੜਾਈ ਝਗੜੇ ਹੋ ਚੁੱਕੇ ਨੇ ਉਸ ਜਮੀਨ ਦੇ ਉੱਤੇ ਤੇ ਇਸ ਕਰਕੇ ਇਹ ਹੀ ਕਹਿਣਾ ਚਾਹਵਾਂਗੇ ਕਿ ਜੋ ਵੀ ਚੀਜ਼ਾਂ ਜਦੋਂ ਵੀ ਜਮੀਨ ਖਰੀਦਣੀ ਹੋਵੇ ਵੇਚਣੀ ਹੋਵੇ ਤਾਂ ਇੱਕ ਵਾਰੀ ਪੁਲਿਸ ਵਾਲਿਆਂ ਦੇ ਨਾਲ ਕੋਂਟੈਕਟ ਕਰ ਲੈਣਾ ਚਾਹੀਦਾ ਜਾਂ ਲੀਗਲੀ ਸਾਰਾ ਕੁਛ ਨੈਟ ਦੇ ਉੱਤੇ ਅੱਜ ਕੱਲ੍ਹ ਤਾਂ ਸਾਰੀਆਂ ਜਮੀਨਾਂ ਦੇ ਨੰਬਰ ਚੜੇ ਹੋਏ ਨੇ ਤਾਂ ਉੱਥੋਂ ਚੈੱਕ ਕਰ ਲੈਣਾ ਚਾਹੀਦਾ ਕਿ ਹਾਂ ਉਹ ਜਮੀਨ ਜਿਹੜੀ ਹੈ ਉਹ ਸਹੀ ਹੈ ਜਾਂ ਰੌਲੇ ਵਾਲੀ ਜਮੀਨ ਹੈ ਬਸ ਇਹ ਹੀ ਕਹਿਣਾ ਚਾਹਵਾਂਗੇ